ਪੰਜਾਬ ਰਾਜ ਵਿੱਚ ਬਹੁਤ ਸਾਰੇ ਹਿੱਸੇ ਹਨ ਜਿਨ੍ਹਾਂ ਦੀ ਆਬਾਦੀ ਵੱਧ ਹੈ ਜਿਵੇਂ ਕਿ ਲੁਧਿਆਣਾ ਸਿਆਲਕੋਟ ਗੁਰਦਾਸਪੁਰ ਅਤੇ ਜਲੰਧਰ ਇਹਨਾਂ ਦੀ ਜਨਸੰਖਿਆ ਦੂਜੇ ਦੂਜੇ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਹੈ ਦੂਜੇ ਸ਼ਹਿਰਾਂ ਨਾਲੋਂ ਇਹਨਾਂ ਦੀ ਜਨਸੰਖਿਆ ਵੱਧ ਇਸ ਕਰਕੇ ਹੈ ਕਿਉਂਕਿ ਇੱਥੋਂ ਦੇ ਲੋਕ ਘੱਟ ਪੜ੍ਹੇ ਲਿਖੇ ਹੁੰਦੇ ਹਨ ਜ਼ਿਆਦਾ ਸੁਚੇਤ ਨਹੀਂ ਹੁੰਦੇ ਅਤੇ ਲੋੜ ਹੈ ਕਿ ਸਰਕਾਰ ਇਹਨਾਂ ਨੂੰ ਸੁਚੇਤ ਕਰੇ ਜਾਣਕਾਰੀ ਦੇਵੇ ਕਿ ਵੱਧ ਜਨਸੰਖਿਆ ਹਮੇਸ਼ਾ ਨੁਕਸਾਨ ਕਰਦੀ ਹੈ ਵੱਧ ਜਨਸੰਖਿਆ ਦੇ ਲਾਭ ਵੀ ਨੇ ਅਤੇ ਨੁਕਸਾਨ ਵੀ ਨੇ ਲਾਭ ਇਹ ਨੇ ਕਿ ਜਦੋਂ ਜਿਹੜੀ ਰਾਜ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਜਾਂ ਜਿਹੜੇ ਸ਼ਹਿਰ ਦੇ ਵਿੱਚ ਜਨਸੰਖਿਆ ਵੱਧ ਹੋਵੇਗੀ ਉਹ ਸਾਰੇ ਲੋਕ ਕਮਾਉਣਗੇ ਅਤੇ ਜਦੋਂ ਪੈਸਾ ਕਮਾਉਣਗੇ ਤਾਂ ਉਸ ਦੇ ਨਾਲ ਕੀ ਹੋਵੇਗਾ ਕਿ ਕੈਪੀਟਲ ਫੋਰਮੇਸ਼ਨ ਹੋਵੇਗੀ ਫੋਰਮੇਸ਼ਨ ਮਤਲਬ ਕੀ ਮੁਦਰਾ ਸਫੀਤੀ ਦੀ ਜਿਹੜੀ ਦਰ ਹੈ ਉਹ ਵਧੇਗੀ ਪਰ ਉਸਦੇ ਨਾਲ ਨਾਲ ਹੀ ਕੀ ਹੈ ਕਿ ਨੌਕਰੀਆਂ ਘੱਟ ਕਿਉਂਕਿ ਜਨਸੰਖਿਆ ਵੱਧ ਹੋਵੇਗੀ ਅਤੇ ਸਾਡੇ ਜੋ ਰਿਸੋਰਸਿਜ ਨੇ ਉਹ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੀਮਿਤ ਨੇ ਅਤੇ ਜੇ ਹੋਰ ਜਨਸੰਖਿਆ ਵੱਧ ਗਈ ਤਾਂ ਜਿਹੜੇ ਬਚੇ ਖੁਚੇ ਰਿਸੋਰਸਿਸ ਹੋਣਗੇ ਉਹਨਾਂ ਦਾ ਉਪਯੋਗ ਹੋ ਜਾਵੇਗਾ ਅਤੇ ਉਹ ਰਿਸੋਰਸਿਸ ਅੱਗੇ ਚੱਲ ਕੇ ਖਤਮ ਹੋ ਜਾਣਗੇ ਜੇ ਜਨਸੰਖਿਆ ਇੱਦਾਂ ਹੀ ਵੱਧਦੀ ਰਹੀ ਤਾਂ ਜਿਹੜੇ ਬਚੇ ਖੁਚੇ ਰਿਸੋਰਸ ਹੋਣਗੇ ਉਹ ਵੀ ਹਮੇਸ਼ਾ ਦੇ ਹਮੇਸ਼ਾ ਦੇ ਲਈ ਖਤਮ ਹੋ ਜਾਣਗੇ ਵੱਧ ਜਨਸੰਖਿਆ ਵਾਤਾਵਰਨ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਾਉਂਦੀ ਹੈ ਇਸ ਦੇ ਨਾਲ ਕੀ ਹੁੰਦਾ ਕਿ ਜੋ ਸਾਡਾ ਪਾਣੀ ਹੈ ਪਾਣੀ ਦੀ ਕਿੱਲਤ ਹੋ ਸਕਦੀ ਹੈ ਜਿਹੜੀਆਂ ਜਗ੍ਹਾਵਾਂ ਜਿਹੜੇ ਸ਼ਹਿਰ ਪਹਿਲਾਂ ਛੋਟੇ ਨੇ ਉਹਨਾਂ ਦੇ ਉੱਤੇ ਭੀੜ ਜ਼ਿਆਦਾ ਹੋ ਸਕਦੀ ਹੈ ਵੱਧ ਜਨਸੰਖਿਆ ਦੇ ਕਾਰਨ ਹੁਣ ਵੀ ਦੇਖਿਆ ਜਾਂਦਾ ਕਿ ਕਈ ਸ਼ਹਿਰਾਂ ਦੇ ਵਿੱਚ ਸ਼ਹਿਰ ਤਾਂ ਵੱਡੇ ਨੇ ਪਰ ਨਿੱਕੀਆਂ ਨਿੱਕੀਆਂ ਥਾਵਾਂ ਨੇ ਜੋ ਉਹਨਾਂ ਦੀਆਂ ਉੱਥੇ ਭੀੜ ਬਹੁਤ ਹੀ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਸੋ ਵੱਧ ਜਨਸੰਖਿਆ ਦਾ ਹਮੇਸ਼ਾ ਲਾਭ ਵੀ ਹੈ ਅਤੇ ਨੁਕਸਾਨ ਵੀ ਹੁੰਦਾ ਆ ਸਕਾਰਾਤਮਕ ਪਹਿਲੂ ਵੀ ਆਪਾਂ ਗਿਣ ਸਕਦੇ ਹਾਂ ਕਿ ਜੇ ਜਨਸੰਖਿਆ ਵੱਧ ਹੋਵੇਗੀ ਅਤੇ ਉਸ ਦੇ ਨਾਲ ਮੁਦਰਾ ਸਫੀਤੀ ਦੀ ਦਰ ਵੀ ਵਧੇਗੀ ਲੋਕ ਜ਼ਿਆਦਾ ਤੋਂ ਜ਼ਿਆਦਾ ਕਮਾਉਣਗੇ ਅਤੇ ਉਸ ਦੇ ਨਾਲ ਕੀ ਹੋਵੇਗਾ ਪੈਸੇ ਦਾ ਨਿਰਯਾਤਾ ਯਾਤ ਹੁੰਦਾ ਰਹੇਗਾ ਪਰ ਨਾਲ ਨਾਲ ਹੀ ਜੇ ਆਪਾਂ ਦੇਖੀਏ ਤਾਂ ਦੂਜੇ ਜਣਿਆਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਹਨ ਅਤੇ ਨੌਕਰੀਆਂ ਦੀ ਘਾਟ ਵੀ ਹੋ ਸਕਦੀ ਹੈ ਅਤੇ ਰਿਸੋਰਸਿਸ ਵੀ ਆਪਣੇ ਘੱਟ ਹੋ ਸਕਦੇ ਨੇ ਵਾਤਾਵਰਨ 'ਤੇ ਵੀ ਬਹੁਤ ਭੈੜਾ ਅਸਰ ਪੈ ਸਕਦਾ ਹੈ